ਕਢਾਈ ਬਾਰੇ ਗੱਲ ਕਰਦੇ ਹੋਏ ਜੇ ਅਸੀਂ ਇਸ ਵਿੱਚ ਅੰਤਰ ਦੀ ਗੱਲ ਕਰੀਏ ਤਾਂ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਇਕ ਹੱਥ ਦੀ ਕਢਾਈ ਅਤੇ ਦੂਜੀ ਮਸ਼ੀਨੀ ਕਢਾਈ ਸਭ ਤੋਂ ਪਹਿਲਾਂ ਹੱਥ ਦੀ ਕਢਾਈ ਦੀ ਗੱਲ ਕਰਦੇ ਹਾਂ ਕਾਰੀਗਰ ਸੂਈ ਅਤੇ ਧਾਗੇ ਦੀ ਵਰਤੋਂ ਕਰਦੇ ਹਨ ਹੱਥ ਦੀ ਕਢਾਈ ਕੱਢਦਾ ਜਿਸ ਵਿੱਚ ਧਾਗੇ ਦੀਆਂ ਅੱਠ ਤੰਦਾਂ ਹੁੰਦੀਆਂ ਹਨ ਅਤੇ ਅਸੀਂ ਇਸ ਨੂੰ ਚਾਰ ਤੰਦਾਂ ਵਿੱਚ ਵੰਡ ਕੇ ਸੂਈ ਵਿੱਚ ਧਾਗਾ ਪਾ ਕੇ ਅਤੇ ਅਸੀਂ ਇਹਦੀ ਕਢਾਈ ਕੱਢਦੇ ਹਾਂ ਪਹਿਲਾਂ ਚਾਦਰਾ ਜਾਂ ਕਿਸੇ ਹੋਰ ਕੱਪੜੇ ਦੇ ਨਾਲ ਹੱਥ ਦੀ ਕਢਾਈ ਕੱਢਣੀ ਹੋਵੇ ਤਾਂ ਪਹਿਲਾਂ ਡਿਜਾਇਨ 'ਚ ਪਵਾਉਣਾ ਹੁੰਦਾ ਆ ਬਾਹਰੋਂ ਡਿਜ਼ਾਇਨ 'ਚ ਪਵਾ ਕੇ ਫਿਰ ਉਹਦੇ ਉੱਤੇ ਹੱਥ ਨਾਲ ਰੰਗ ਬਿਰੰਗੇ ਧਾਗਿਆਂ ਦੇ ਨਾਲ ਅਸੀਂ ਕਢਾਈ ਕੱਢਦੇ ਹਾਂ ਫੁੱਲ ਬੂਟੇ ਪਵਾ ਕੇ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਇਨ ਪਾ ਕੇ ਅਤੇ ਅਸੀਂ ਕਢਾਈ ਕੱਢਦੇ ਹਾਂ ਜੇ ਅਸੀਂ ਮਸ਼ੀਨੀ ਕਢਾਈ ਦੀ ਗੱਲ ਕਰੀਏ ਤਾਂ ਇਹ ਇੱਕ ਨਵੀਂ ਤਕਨੀਕ ਆ ਜਿਸ ਵਿੱਚ ਤਕਨੀਕ ਆ ਇਸ ਵਿੱਚ ਪ੍ਰੀਮੀਅਰ ਕਢਾਈ ਵੀ ਕੀਤੀ ਜਾਂਦੀ ਹੈ ਮਸ਼ੀਨੀ ਕਢਾਈ ਨਾਲ ਅਸੀਂ ਫੈਂਸੀ ਤੋਂ ਫੈਂਸੀ ਡਿਜ਼ਾਇਨ ਵੀ ਤਿਆਰ ਕਰ ਸਕਦੇ ਹਾਂ ਅਤੇ ਇਹਦੇ ਵਿੱਚ ਸਮੇਂ ਦੀ ਵਰਤੋਂ ਵੀ ਘੱਟ ਹੁੰਦੀ ਹੈ ਇਸ ਵਿੱਚ ਅਸੀਂ ਵੱਧ ਤੋਂ ਵੱਧ ਸਵੈਟਰ ਜਾਂ ਹੋਰ ਡਿਜਾਇਨਿੰਗ ਕਰ ਸਕਦੇ ਹਾਂ ਜੇ ਅਸੀਂ ਇਸ ਦੇ ਵਿਚਲੇ ਅੰਤਰ ਦੀ ਗੱਲ ਕਰੀਏ ਤਾਂ ਅੱਜ ਦੇ ਯੁੱਗ ਵਿੱਚ ਮਸ਼ੀਨੀ ਕਢਾਈ ਜ਼ਿਆਦਾ ਬਿਹਤਰ ਹੈ ਅੱਜ ਕੱਲ੍ਹ ਦੇ ਲੋਕਾਂ ਕੋਲ ਅੱਜ ਕੱਲ੍ਹ ਦੇ ਲੋਕਾਂ ਦੀ ਡਿਮਾਂਡ 'ਤੇ ਦੇ ਅਕੋਰਡਿੰਗ ਅਕੋਰਡਿੰਗ ਮਸ਼ੀਨੀ ਕਢਾਈ ਬਿਹਤਰ ਹੈ ਹੱਥ ਦੀ ਕਢਾਈ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਦੇ ਲੋਕਾਂ ਕੋਲ ਸਮੇਂ ਦੀ ਘਾਟ ਕਰਕੇ ਸਮੇਂ ਦੀ ਘਾਟ ਕਰਕੇ ਦੀ ਵਰਤੋਂ ਘੱਟ ਗਈ ਹੈ ਲੋਕਾਂ ਕੋਲ ਇੰਨਾਂ ਟਾਈਮ ਹੀ ਹੈ ਨਹੀਂ ਕਿ ਉਹ ਆਪਣੇ ਹੱਥਾਂ ਦੇ ਨਾਲ ਕਢਾਈਆਂ ਕੱਢਣ ਪਹਿਲੇ ਸਮੇਂ ਸੀ ਅਤੇ ਲੋਕੀ ਹੱਥਾਂ ਨਾਲ ਇਹ ਆਹਰ ਦੇ ਨਾਲ ਸਾਰੇ ਕੰਮ ਕਰਦੇ ਸੀ ਪਰ ਹੁਣ ਅੱਜ ਕੱਲ੍ਹ ਇਹ ਸਭ ਕੁਛ ਘੱਟ ਗਿਆ ਹੈ ਕਿਉਂਕਿ ਲੋਕਾਂ ਕੋਲ ਸਮਾਂ ਹੀ ਨਹੀਂ ਹੈ ਅਤੇ ਜੇਕਰ ਅਸੀਂ ਮਸ਼ੀਨੀ ਕਢਾਈ ਦੀ ਗੱਲ ਕਰੀਏ ਕਿ ਉਹ ਬਿਹਤਰ ਹੈ ਉਹਦੇ ਨਾਲ ਸਾਨੂੰ ਹਰ ਤਰ੍ਹਾਂ ਦੇ ਮਾਰਕੀਟ ਵਿੱਚੋਂ ਹਰ ਤਰ੍ਹਾਂ ਦੇ ਨਵੇਂ ਨਵੇਂ ਤਰ੍ਹਾਂ ਦੀ ਡਿਜ਼ਾਇਨਿੰਗ ਮਿਲ ਜਾਂਦੀ ਹੈ ਅਤੇ ਇੰਡੀਅਨ ਵੈਸਟਰਨ ਹਰ ਤਰ੍ਹਾਂ ਦੀ ਪੁਸ਼ਾਕਾਂ ਸਾਨੂੰ ਬਣੀਆਂ ਬਣਾਈਆਂ ਮਿਲ ਜਾਂਦੀਆਂ ਹਨ ਧੰਨਵਾਦ